ਕਰਮਜੀਤ ਸਿੰਘ ਸੇ ਬਾਤ ਹੋ ਰਹੀ ਹੈ ਮੈਂ ਮੈਂ ਤੁਹਾਡੇ ਸਕੂਲ ਦੀ ਟੀਚਰ ਇਸ ਵਾਰੀ ਜਿਹੜੇ ਪੇਪਰ ਹੋਏ ਉਹ 'ਚ ਤੁਹਾਡੀ ਪ੍ਰਫੋਰਮੈਂਸ ਥੋੜ੍ਹੀ ਖ਼ਰਾਬ ਸੀਗੀ ਇਸ ਕਰਕੇ ਫ਼ੋਨ ਕਰ ਰਹੀ ਕੀ ਕੀ ਰੀਜਨ ਹੈਗਾ ਸੀ ਇਹਦਾ ਜੋ ਮਾਰਕਸ ਤੁਹਾਡੇ ਬਹੁਤ ਘੱਟ ਆਏ ਪ੍ਰੀਵੀਅਸ ਦੇ ਹਿਸਾਬ ਨਾਲ਼ ਠੀਕ ਹੈ ਮਤਲਬ ਮੈਂ ਇਹੀ ਪੁੱਛਣਾ ਸੀਗਾ ਕਿ ਇੰਨੀ ਘੱਟ ਪ੍ਰਫੋਰਮੈਂਸ ਕਿਉਂ ਕਿਉਂਕਿ ਇੰਨੀ ਕਦੇ ਤੁਹਾਡੀ ਇੰਨੀ ਘੱਟ ਪ੍ਰਫੋਰਮੈਂਸ ਹੋਈ ਨਹੀਂ ਚਲੋ ਹੁਣ ਹਾਂਜੀ ਹੁਣ ਤੁਹਾਡੀ ਤਬੀਅਤ ਸਹੀ ਹੈ

ਓਕੇ ਨੈਕਸਟ ਵਾਰੀ ਵਧੀਆ ਨੰਬਰ ਲੈ ਲਿਓ ਤੁਸੀਂ ਫੇਲ ਤਾਂ ਨਹੀਂ ਕਿਸੇ ਸਬਜੈਕਟ 'ਚੋਂ ਪਾਸਿੰਗ ਮਾਰਕਸ ਆਏ ਸਾਰੇ ਸਬਜੈਕਟਸ 'ਚ ਬਾਕੀ ਤੁਸੀਂ ਔਫਿਸ ਤੋਂ ਪਤਾ ਕਰ ਲਿਓ ਸਕੂਲ ਆ ਕੇ ਜਦੋਂ ਵੀ ਮੰਡੇ ਨੂੰ ਜਾਂ ਕਦੇ ਵੀ ਸਕੂਲ ਲੱਗਣਗੇ ਤਾਂ ਓਕੇ ਓਕੇ ਓਕੇ